ਸਰਕਾਰੀ ਪਹਿਲਕਦਮੀਆਂ ਜੋ ਮੈਨੂੰ ਲੱਗਦੀਆਂ ਉਹ ਇਸ ਪ੍ਰਕਾਰ ਨੇ ਸਭ ਤੋਂ ਪਹਿਲਾਂ ਜਿਵੇਂ ਕਿ ਸ਼ਹਿਰਾਂ ਦੇ ਵਿੱਚ ਪਾਣੀ ਦੇ ਨਿਕਾਸ ਬਾਰੇ ਬਹੁਤ ਜ਼ਿਆਦਾ ਸੀਵਰੇਜ ਪਾ ਦਿੱਤੇ ਗਏ ਨੇ ਲੇਕਿਨ ਇਹਨਾਂ ਦੇ ਉੱਪਰ ਪਿੰਡਾਂ ਦੇ ਵਿੱਚ ਵੀ ਕੰਮ ਕਰਨ ਦੀ ਬਹੁਤ ਜ਼ਿਆਦਾ ਸਖਤ ਜ਼ਰੂਰਤ ਆ ਔਰ ਇਹ ਰੋਡ ਜਿਵੇਂ ਕਿ ਬਹੁਤ ਜ਼ਿਆਦਾ ਵਧੀਆ ਰੋਡ ਹੋ ਗਏ ਨੇ ਫੋਰ ਲਾਈਨ ਰੋਡ ਵੀ ਆ ਗਏ ਏ ਔਰ ਫਲਾਈਓਵਰ ਆ ਗਏ ਔਰ ਇਸ ਪ੍ਰਕਾਰ ਜਿਹੜੇ ਲਿੰਕ ਰੋਡ ਆ ਉਹਨਾਂ ਨੂੰ ਬਹੁਤ ਜ਼ਿਆਦਾ ਠੀਕ ਕਰਨ ਦੀ ਜ਼ਰੂਰਤ ਆ ਉਹਦੇ ਦੇ ਉੱਪਰ ਕੰਮ ਕਰਨਾ ਚਾਹੀਦਾ ਹੈ ਇਸ ਤੋਂ ਬਿਨਾਂ ਸਕੂਲ ਜਿਹੜੇ ਸਕੂਲ ਆ ਪ੍ਰਾਈਵੇਟ ਸਕੂਲ ਬਹੁਤ ਜ਼ਿਆਦਾ ਵਧੀਆ ਹੈ ਸਰਕਾਰ ਪ੍ਰਾਈ ਜਿਹੜੇ ਗੌਰਮਿੰਟ ਸਕੂਲ ਆ ਉਹਨਾਂ ਨੂੰ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਪਿੰਡਾਂ ਦੇ ਵਿਚ ਕੰਮ ਕਰਨਾ ਅਜੇ ਬਹੁਤ ਜ ਚਾਹੀਦਾ ਜਿਵੇਂ ਕਿ ਪ੍ਰਾਇਮਰੀ ਸਕੂਲ ਆ ਉਹਨਾਂ ਦੇ ਉੱਪਰ ਕੰਮ ਕਰਨਾ ਬਾਕੀ ਹੈ ਔਰ ਇਸ ਤੋਂ ਬਿਨਾਂ ਹੋਸਪਿਟਲ ਇੱਥੇ ਜਿਵੇਂ ਕਿ ਪਰਮਾਰ ਹੋਸਪਿਟਲ ਆ ਸੁਰਜੀਤ ਹੋ ਗਿਆ ਬਜਿੰਦਰਾ ਹੋ ਗਿਆ ਸਿੰਘ ਹੋਸਪਿਟਲ ਹੋ ਗਿਆ ਕਈ ਪ੍ਰਕਾਰ ਦੇ ਹੋਸਪਿਟਲ ਰੋਪੜ ਡਿਸਟਿਕ ਦੇ ਵਿਚ ਬ ਹੈ ਸ਼ਹਿਰ ਦੇ ਵਿੱਚ ਨੇ ਜਿਹਦੇ ਨਾਲ ਕੇ ਮਰੀਜ਼ ਨੂੰ ਔਰ ਇਹਦੇ ਨਾਲ ਨਾਲ ਈ ਸੀ ਐੱਸ ਸਰਵਿਸ ਵੀ ਪ੍ਰੋਵਾਈਡ ਆ ਜਿਹਦੇ ਨਾਲ ਕਿ ਸਾਨੂੰ ਜ਼ਿਆਦਾ ਪੀ ਜੀ ਆਈ ਦਾ ਰਸਤਾ ਫੜਨ ਦੀ ਜ਼ਰੂਰਤ ਨਹੀਂ ਪੈਂਦੀ ਔਰ ਜ਼ਿਆਦਾਤਰ ਇਲਾਜ ਇੱਥੇ ਹੋ ਜਾਂਦਾ ਏ ਬਹੁਤ ਕੋਈ ਇੱਕ ਅੱਧਾ ਕੇਸ ਆ ਜਿਹੜਾ ਪੀ ਜੀ ਆਈ ਜਾਂਦਾ ਉਸ ਤੋਂ ਬਿਨਾਂ ਨ ਬੈਕਾਂ ਦੇ ਵਿੱਚ ਬਹੁਤ ਜ਼ਿਆਦਾ ਪਹਿਲਾਂ ਭੀੜ ਦੇਖੀ ਜਾਂਦੀ ਸੀ ਅੱਜ ਕੱਲ੍ਹ ਬੈਕਾਂ ਦੇ ਵਿੱਚ ਟੋਕਨ ਸਿਸਟਮ ਚੱਲ ਪਿਆ ਔਰ ਔਨਲਾਈਨ ਬਹੁਤ ਵਧੀਆ ਕੰਮ ਚੱਲਦਾ ਏ ਔਰ ਪੁਰਾਣੇ ਜ਼ਮਾਨੇ ਦੇ ਮੁਕਾਬਲੇ ਅੱਜ ਬਹੁਤ ਜ਼ਿਆਦਾ ਸੁਵਿਧਾ ਹੈਗੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ ਹੋ ਸਕਦਾ ਹੈ ਔਰ ਇਸ ਤਰੀਕੇ ਨਾਲ ਮੈਨੂੁੰ ਲੱਗਦਾ ਕਿ ਸਰਕਾਰ ਹੋਰ ਵਧੀਆ ਕਰੇਗੀ